ਐਸਾ ਕੋਈ ਵਿਅਕਤੀ ਜੋ ਗਾਉਣਾ ਚਾਹੁੰਦਾ ਹੈ ਜਾਂ ਆਪਣੇ ਗਾਇਕੀ ਦੇ ਹੁਨਰ ਨੂੰ ਸੁਧਾਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਐਸਾ ਵਿਅਕਤੀ ਜਿਹਦਾ ਗਾਇਕੀ ਵਿੱਚ ਬਹੁਤ ਮਨ ਹੈ ਤਾਂ ਉਹਦੇ ਉੱਤੇ ਮੈਂ ਮੰਨ ਕੇ ਚੱਲਦਾ ਕਿ ਪਰਮਾਤਮਾ ਦੀ ਬੜੀ ਵਿਸ਼ੇਸ਼ ਕ੍ਰਿਪਾ ਹੈ ਕਾਰਣ ਕਿ ਜਦੋਂ ਆਪਾਂ ਸੁਰਾਂ ਦੇ ਨਾਲ ਆਪਣੇ ਆਪ ਨੂੰ ਤੈਰਦਾ ਹੋਇਆ ਕਦੇ ਮਹਿਸੂਸ ਕਰਦੇ ਹਾਂ ਨਾ ਤਾਂ ਉਸ ਸਮੇਂ ਆਪਾਂ ਦੁਨੀਆ ਤੋਂ ਜ਼ਿਆਦਾ ਰੱਬ ਦੇ ਜ਼ਿਆਦਾ ਨੇੜੇ ਹੁੰਦੇ ਹੈ ਕਾਰਣ ਇਹ ਹੈ ਕਿਉਂਕਿ ਗੁਰ ਨਾਨਕ ਗੁਰੂ ਨਾਨਕ ਪਾਤਸ਼ਾਹ ਉਹ ਵੀ ਆਪਣੇ ਨਾਲ ਆਪਣੇ ਨਾਲ ਮਰਦਾਨਾ ਜੀ ਨੂੰ ਰੱਖਦੇ ਸਨ ਅਤੇ ਉਹ ਮਹਾਪੁਰਸ਼ਾਂ ਦੀ ਬਾਣੀ ਨੂੰ ਸਾਰੰਗੀ ਦੇ ਸੁਰਾਂ ਵਿੱਚ ਪਰੋ ਕੇ ਸੰਗਤ ਅੱਗੇ ਪੇਸ਼ ਕਰਦੇ ਹਨ ਜਿਹਦੇ ਨਾਲ ਪ੍ਰਭਾਵ ਕੀ ਹੁੰਦਾ ਸੀ ਕਿ ਜੀਹਨੇ ਨਹੀਂ ਵੀ ਬਾਣੀ ਦੇ ਅੱਖਰਾਂ ਨੂੰ ਸੁਣਨਾ ਉਹ ਸਵਰਾਂ ਦੇ ਬੰਨਾਂ ਵਿੱਚ ਕੈਦ ਹੋ ਕੇ ਜਾਂ ਕਹੋ ਕਿ ਉਹਨਾਂ ਵਿੱਚ ਤੈਰ ਕੇ ਇੱਕ ਸਧਾਰਨ ਵਿਅਕਤੀ ਵੀ ਉਸ ਬਾਣੀ ਨੂੰ ਸੁਣ ਲੈਂਦਾ ਸੀ ਇਸ ਲਈ ਅਗਰ ਕੋਈ ਵਿਅਕਤੀ ਗਾਇਕੀ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਬਿਲਕੁਲ ਸ਼ੁਰੂ ਕਰਨੀ ਚਾਹੁੰਦੀ ਹੈ ਚਾਹੀਦੀ ਹੈ ਅਤੇ ਕਿਸੇ ਐਸੇ ਗੁਰੂ ਕੋਲ ਜਾਕਰ ਜੋ ਇਸ ਹੁਨਰ 'ਚ ਇਸ ਕਲਾ 'ਚ ਪਾਰੰਗਤ ਹੈ ਜ਼ਰੂਰ ਉਹਦੇ ਚਰਨਾਂ ਵਿੱਚ ਬੇਨਤੀ ਕਰੇ ਕਿ ਮੇਰੀ ਗਲੇ ਨੂੰ ਮੇਰੇ ਕੰਠ ਨੂੰ ਤੁਸੀਂ ਐਸੀ ਸਥਿੱਤੀ 'ਚ ਲਿਆ ਦੇਵੋ ਤਾਂ ਕਿ ਜੋ ਵੀ ਮੈਂ ਬੋਲਾਂ ਜਾਂ ਗਾਵਾਂ ਉਹ ਲੋਕਾਂ ਦੇ ਦਿਲਾਂ ਨੂੰ ਛੂਹ ਜਾਵੇ ਜੀ ਧੰਨਵਾਦ